ਇਹ ਅਨੁਭਵ ਮੇਰਾ ਜਿਹੜਾ ਪਹਿਲਾਂ ਸੀਗਾ ਮੈਂ ਜਦੋਂ ਛੇਵੀਂ ਕਲਾਸ ਦੇ ਵਿੱਚ ਸੀ ਤਾਂ ਮੈਂ ਇੱਕ ਫਿਲਮ ਦੇਖੀ ਫਿਲਮ ਦਾ ਨਾਮ ਸੀ ਟਾਈ ਟੈਨਿਕ ਅਤੇ ਮੈਨੂੰ ਜਹਾਜ਼ਾਂ ਦਾ ਬਹੁਤ ਜ਼ਿਆਦਾ ਸ਼ੌਕ ਸੀਗਾ ਸਮੁੰਦਰੀ ਜਹਾਜ਼ ਤਾਂ ਮੈਂ ਹਮੇਸ਼ਾ ਸਮੁੰਦਰੀ ਜਹਾਜ਼ ਸੀ ਜਿਹੜੇ ਆਪਣੀ ਕਾਪੀ 'ਤੇ ਆਪਣੀ ਫਾਈਲ 'ਤੇ ਡਰਾ ਕਰਦਾ ਰਹਿੰਦਾ ਸੀਗਾ ਉਹਦਾ ਚਿੱਤਰ ਬਣਾਉਂਦਾ ਉਹਦੇ 'ਚ ਰੰਗ ਭਰਨੇ ਉਸਦੇ ਘਟਨਾਕ੍ਰਮ ਬਾਰੇ ਦਰਸਾਉਣਾ ਤਾਂ ਹਮੇਸ਼ਾ ਇਹੀ ਮੈਂ ਚੀਜ਼ ਕਰਦਾ ਰਹਿੰਦਾ ਸੀਗਾ ਤਾਂ ਉੱਥੋਂ ਮੇਰੇ ਪੇਰੈਂਟਸ ਨੇ ਜਿਹੜਾ ਸੋਚਿਆ ਵੀ ਕਿਉਂ ਨਾ ਇਸ ਨੂੰ ਕਲਾ ਦੇ ਚਿੱਤਰ ਵਿੱਚ ਕਲਾ ਦੇ ਖੇਤਰ ਵਿੱਚ ਇਹਦਾ ਜਿਹੜਾ ਕਦਮ ਰਖਵਾਇਆ ਜਾਵੇ ਤਾਂ ਮੈਨੂੰ ਥੋੜ੍ਹਾ ਹੋਰ ਸਿੱਖਣ ਦਾ ਮੌਕਾ ਮਿਲਿਆ ਫਿਰ ਮੈਂ ਫਲਾਂ ਦੇ ਚਿੱਤਰ ਜਾਂ ਪੰਜਾਬੀ ਵਿੱਚ ਜਿਵੇਂ ਲਿਖਾਵਟ ਹੁੰਦੀ ਹੈ ਤਾਂ ਉਸ ਦੇ ਚਿੱਤਰ ਬਣਾਉਣੇ ਸ਼ੁਰੂ ਕੀਤੇ ਜਿਵੇਂ ਕਿ ਕੰਧ ਉੱਪਰ ਮੈਂ ਜੇ ਕੁਝ ਲਿਖਿਆ ਦੇਖਿਆ ਵੀ ਜਿਵੇਂ ਕਿ ਇੱਕ ਕੋਟ ਲਿਖਿਆ ਦੇਖਿਆ ਪੰਜਾਬੀ 'ਚ ਉਸ ਨੂੰ ਇੱਕ ਸੁੰਦਰ ਸ਼ਬਦਾਂ ਦੇ ਰੂਪ ਵਿੱਚ ਮੈਂ ਦੇਣ ਦੀ ਕੋਸ਼ਿਸ਼ ਕਰਦਾ ਉਸਦੇ ਵਿੱਚ ਰੰਗਾਂ ਦਾ ਕੰਬੀਨੇਸ਼ਨ ਆਉਂਦਾ ਰੰਗ ਭਰਦਾ ਉਸ ਦੇ ਵਿੱਚ ਸਫਾਈ ਦਾ ਧਿਆਨ ਰੱਖਿਆ ਫਿਰ ਹੌਲੀ ਹੌਲੀ ਜਿਹੜਾ ਕਿਵੇਂ ਪੈਨਸਿਲ ਸੇਡਿੰਗ ਦੇ ਵੱਲ ਵਧਿਆ ਪੈਨਸਿਲ ਸ਼ੇਡਿੰਗ ਦੇ ਵਿੱਚ ਮੈਂ ਚਿੱਤਰ ਬਣਾਉਣੇ ਉਹਨਾਂ ਨੂੰ ਸ਼ੇਡ ਕਰਨਾ ਜਿਵੇਂ ਕਿ ਇੱਕ ਫਲ ਦਾ ਚਿੱਤਰ ਸਾਹਮਣੇ ਰੱਖ ਕੇ ਉਸ ਨੂੰ ਡਰਾ ਕਰਨਾ ਕਿੱਧਰੋਂ ਰੋਸ਼ਨੀ ਆ ਰਹੀ ਹੈ ਉਸ ਦੀ ਛਾਂ ਉਹਨੂੰ ਬਣਾਉਣਾ ਤਾਂ ਇਹਨਾਂ ਚੀਜ਼ਾਂ ਨਾਲ ਆਪਣੀ ਸ਼ੁਰੂਆਤ ਕੀਤੀ ਅਤੇ ਦਸਵੀਂ ਦੇ ਵਿੱਚ ਮੈਂ ਆਪਣੀ ਜਮਾਤ ਪੂਰੀ ਕਰਨ ਤੋਂ ਬਾਅਦ ਮੈਂ ਇੱਕ ਇੰਸਟੀਟਿਊਟ ਵਿੱਚ ਦਾਖਲਾ ਲਿਆ ਜਿਸਦਾ ਨਾਮ ਸੀ ਸੁਖਮਣੀ ਇੰਸਟੀਟਿਊਟ ਆਫ ਆਰਟ ਐਨ ਕਰਾਫਟ ਅਤੇ ਦਾਖਲਾ ਲਿਆ ਅਤੇ ਮੈਂ ਜਿਹੜਾ ਦੋ ਸਾਲ ਦਾ ਉੱਥੋਂ ਕੋਰਸ ਕੀਤਾ ਉਸ ਦੇ ਵਿੱਚ ਸਾਨੂੰ ਪੈਂਸਿਲ ਸ਼ੀਡਿੰਗ ਕਲਰ ਦਾ ਕੰਬੀਨੇਸ਼ਨ ਅਤੇ ਆਇਲ ਪੇਸਟਰ ਕਲਰ ਵਾਟਰ ਕਲਰ ਅਜਿਹੇ ਹੋਰ ਕਈ ਕਿਸਮਾਂ ਦੇ ਰੰਗ ਜਿਹੜੇ ਸਾਨੂੰ ਵਰਤਣੇ ਸਿਖਾਏ ਗਏ ਉਸ ਦੇ ਵਿੱਚ ਸਾਨੂੰ ਇੱਕ ਹੈਂਡਮੇਟ ਸ਼ੀਟਹੈਂਡਮੇਟ ਸ਼ੀਟ ਹੁੰਦੀ ਸੀ ਜਿਹੜੀ ਕਿ ਧਾਗਿਆਂ ਤੋਂ ਬਣੀ ਹੁੰਦੀ ਸੀਗੀ ਉਸ ਦੇ ਉੱਪਰ ਅਸੀਂ ਡਰਾ ਕਰਦੇ ਕੋਈ ਪੱਖੇ ਦਾ ਡਿਜ਼ਾਇਨ ਨੂੰ ਰੁਮਾਲ ਦਾ ਡਿਜ਼ਾਇਨ ਅਤੇ ਹੱਥੀਂ ਲਿਖਾਵਟ ਜਿਹੜੇ ਕਿ ਆਪਾਂ ਅੱਖਰ ਬਣਾਉਣੇ ਉਹ ਕਿੰਨੇ ਦੇ ਡਾਇਆਮੀਟਰ ਵਿੱਚ ਬਣਦੇ ਨੇ ਇਸ ਤਰ੍ਹਾਂ ਮੈਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ